ਹਾਂਜੀ ਮੈਂ ਸੋਸ਼ਲ ਮੀਡੀਆ 'ਤੇ ਆਪਣੀਆਂ ਫੋਟੋਆਂ ਤਸਵੀਰਾਂ ਪੋਸਟ ਕਰਦੀ ਹਾਂ ਤਾਂ ਜੋ ਉਹ ਇੱਕ ਯਾਦਗਿਰੀ ਬਣ ਕੇ ਸੋਸ਼ਲ ਮੀਡੀਆ 'ਤੇ ਸੇਵ ਹੋ ਜਾਵੇ ਅਤੇ ਜਦੋਂ ਮੇਰਾ ਦਿਲ ਕਰੇ ਮੈਂ ਉਹ ਵੇਖ ਸਕਾਂ ਮੈਨੂੰ ਫੋਟੋਗ੍ਰਾ੍ਫੀ ਦਾ ਬਹੁਤ ਸ਼ੌਂਕ ਹੈ ਅਤੇ ਹਰ ਇੱਕ ਜਗ੍ਹਾ 'ਤੇ ਮੈਨੂੰ ਐਵੇਂ ਹੁੰਦਾ ਕਿ ਮੈਂ ਫੋਟੋ ਕਲਿੱਕ ਕਰਕੇ ਆਪਣੇ ਫੋਨ ਵਿੱਚ ਉਹਨੂੰ ਸੇਵ ਕਰਕੇ ਰੱਖ ਸਕਾਂ ਮੈਂ ਆਪਣੇ ਫੋਨ ਵਿੱਚ ਸਨੈਪਚੈਟ ਇੰਸਟਾ ਫੇਸਬੁੱਕ ਵਟਸਅਪ ਦੀ ਵਰਤੋਂ ਕਰਦੀ ਹਾਂ ਸਨੈਪਚੈਟ ਅਤੇ ਇੰਸਟਾ 'ਤੇ ਮੈਨੂੰ ਬਹੁਤ ਵਿਊ ਆਉਂਦੇ ਹਨ ਅਤੇ ਸੋਸ਼ਲ ਮੀਡੀਆ ਮੈਂ ਅਤੇ ਸੋਸ਼ਲ ਮੀਡੀਆ ਰਾਹੀਂ ਮੈਂ ਆਪਣੀ ਆਮਦਨ ਵੀ ਪ੍ਰਾਪਤ ਕਰਦੀ ਹਾਂ ਮੈਨੂੰ ਸੋਸ਼ਲ ਮੀਡੀਆ ਅਤੇ ਸਨੈਪਚੈਟ ਵਿੱਚ ਫਿਲਟਰ ਲਾ ਕੇ ਫੋਟੋਆਂ ਖਿੱਚਣ ਦਾ ਵੀ ਬਹੁਤ ਸ਼ੌਕ ਹੈ ਅਤੇ ਉਹ ਫੋਟੋਆਂ ਕਲਿੱਕ ਕਰਕੇ ਮੈਂ ਇਨਸ ਸਨੈਪਚੈਟ 'ਤੇ ਹੀ ਪੋਸਟ ਕਰਦੀ ਹਾਂ ਸਨੈਪਚੈਟ 'ਤੇ ਵੀ ਪੋਸ਼ਟ ਪੋਸਟ ਕਰਦੀ ਹਾਂ ਜਿਹਦੇ ਨਾਲ ਮੈਨੂੰ ਬਹੁਤ ਸਾਰੇ ਲਾਈਕ ਕਮੈਂਟ ਅਤੇ ਵਿਊ ਆਉਂਦੇ ਹਨ ਅਤੇ ਲੋਕਾਂ ਨੂੰ ਵੀ ਉਹ ਤਸਵੀਰਾਂ ਬਹੁਤ ਪਸੰਦ ਆਉਂਦੀਆਂ ਹਨ ਜਿਹਦੇ ਜਿੰਨੇ ਹੀ ਵਿਊ ਉਹ ਵੱਧਦੇ ਹਨ ਉਸ ਫੋਟੋ 'ਤੇ ਓਨੇ ਹੀ ਮੈਨੂੰ ਲਾਈਕ ਅਤੇ ਕਮੈਂਟ ਮਿਲਦੇ ਹਨ